ਖੇਡਾਂ ਦੇ ਵਿੱਚ ਸਪੋਂਸਰਾਂ ਦੀ ਬਹੁਤ ਅਹਿਮ ਭੂਮਿਕਾ ਹੁੰਦੀ ਹੈ ਕਿਉਂਕਿ ਖੇਡਾਂ ਕਰਵਾਉਣ ਵਿੱਚ ਵੀ ਕਾਫ਼ੀ ਪੈਸੇ ਦੀ ਜ਼ਰੂਰਤ ਹੁੰਦੀ ਹੈ ਅਤੇ ਅਗਰ ਖੇਡਾਂ ਨੂੰ ਸਪੋਂਸਰ ਕਰਨਗੇ ਤਾਂ ਹੀ ਪੈਸਾ ਆਊਗਾ ਖੇਡਾਂ ਜਿੱਥੇ ਵੀ ਕਿਤੇ ਹੁੰਦੀਆਂ ਹਨ ਦੋ ਜਾਂ ਤਿੰਨ ਦਿਨ ਚੱਲਦੀਆਂ ਹਨ ਉੱਥੇ ਅਲੱਗ ਅਲੱਗ ਪਿੰਡਾਂ 'ਚੋਂ ਜ਼ਿਲ੍ਹਿਆਂ 'ਚੋਂ ਬੱਚੇ ਆਉਂਦੇ ਨੇ ਉਨ੍ਹਾਂ ਦਾ ਖਾਣ ਪੀਣ ਉਨ੍ਹਾਂ ਦੇ ਰਹਿਣ ਸਹਿਣ ਲਈ ਪੈਸੇ ਦੀ ਜ਼ਰੂਰਤ ਹੁੰਦੀ ਹੈ ਤਾਂ ਉਹ ਸਾਰਾ ਖਰਚਾ ਆਪਾਂ ਨੂੰ ਸਪੋਂਸਰਾਂ ਤੋਂ ਹੀ ਆਉਂਦਾ ਹੈ ਇਸ ਕਰਕੇ ਖੇਡਾਂ ਦੇ ਵਿੱਚ ਸਪੋਂਸਰਾਂ ਦੀ ਅਹਿਮ ਭੂਮਿਕਾ ਦੇਖਣ ਨੂੰ ਮਿਲਦੀ ਹੈ ਔਰ ਇਸ਼ਤਿਹਾਰਾਂ ਦਾ ਵੀ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਪਿੰਡਾਂ ਦੇ ਵਿੱਚ ਬੱਚਿਆਂ ਨੂੰ ਨਹੀਂ ਪਤਾ ਲੱਗਦਾ ਕਿ ਕਿਸ ਤਰ੍ਹਾਂ ਖੇਡਾਂ ਕਿੱਥੇ ਅਤੇ ਕਦੋਂ ਹੋਣੀਆਂ ਹਨ ਜਦ ਜਿੰਨਾ ਚਿਰ ਇਸ ਦੀ ਸੂਚਨਾ ਜਾਂ ਅਨਾਊਂਸਮੈਂਟ ਸਾਰੇ ਪਿੰਡਾਂ ਸ਼ਹਿਰਾਂ ਦੇ ਵਿੱਚ ਨਹੀਂ ਹੁੰਦੀ ਕਿਸੇ ਨੂੰ ਨਹੀਂ ਪਤਾ ਚੱਲਦਾ ਕਿ ਖੇਡਾਂ ਕਦੋਂ ਅਤੇ ਕਿੱਥੇ ਹੋਣੀਆਂ ਨੇ ਇਸ ਕਰਕੇ ਖੇਡਾਂ ਦੇ ਵਿੱਚ ਇਸ਼ਤਿਹਾਰਾਂ ਦੀ ਭੂਮਿਕਾ ਨੂੰ ਵੀ ਆਪਾਂ ਅਹਿਮ ਮੰਨ ਸਕਦੇ ਹਾਂ ਸਪੋਂਸਰਾਂ ਅਤੇ ਇਸ਼ਤਿਹਾਰਾਂ ਤੋਂ ਬਿਨਾ ਖੇਡਾਂ ਨਹੀਂ ਹੋ ਸਕਦੀਆਂ ਔਰ ਇਸ ਵਿੱਚ ਖੇਡਾਂ ਖਿਡਾਉਣ ਵਾਸਤੇ ਇਸ਼ਤਿਹਾਰ ਲਗਾਉਣਾ ਪਿੰਡਾਂ ਦੇ ਵਿੱਚ ਬੱਚਿਆਂ ਨੂੰ ਸੂਚਿਤ ਕਰਨਾ ਜਾਂ ਜਿੱਥੋਂ ਜਿੱਥੋਂ ਬੱਚੇ ਖੇਡਣਾ ਚਾਹੁੰਦੇ ਹਨ ਉਨ੍ਹਾਂ ਨੂੰ ਇਸ਼ਤਿਹਾਰਾਂ ਤੋਂ ਹੀ ਪਤਾ ਲੱਗਦਾ ਹੈ ਕਿ ਖੇਡਾਂ ਕਿੱਥੇ ਹੋ ਰਹੀਆਂ ਹਨ ਅਤੇ ਅਸੀਂ ਕਿੱਥੇ ਜਾਣਾ ਹੈ ਕਿੰਨੇ ਦਿਨ ਦੀਆਂ ਹਨ ਕਦੋਂ ਜਾਵਾਂਗੇ ਕਦੋਂ ਆਵਾਂਗੇ ਇਹ ਸਭ ਬੱਚਿਆਂ ਨੂੰ ਨੌਲੇਜ ਇਸ਼ਤਿਹਾਰਾਂ ਤੋਂ ਹੀ ਮਿਲਦੀ ਹੈ ਇਸ਼ਤਿਹਾਰਾਂ ਦੇ ਵਿੱਚ ਫੋਨ ਨੰਬਰ ਦਿੱਤਾ ਹੁੰਦਾ ਹੈ ਜਿੱਥੋਂ ਬੱਚੇ ਫੋਨ ਕਰਕੇ ਪੁੱਛ ਸਕਦੇ ਹਨ ਵੀ ਅਸੀਂ ਕਦੋਂ ਆਉਣਾ ਕਦੋਂ ਜਾਣਾ ਹੈ ਇਸ ਕਰਕੇ ਖੇਡਾਂ ਦੇ ਵਿੱਚ ਸਪੋਂਸਰਾਂ ਅਤੇ ਇਸ਼ਤਿਹਾਰਾਂ ਦੀ ਅਹਿਮ ਭੂਮਿਕਾ ਹੈ